ਹੈਲੋ ਸਤਿ ਸ਼੍ਰੀ ਅਕਾਲ ਜੀ ਪ੍ਰੀਤ ਡਿਲੈਕਸ ਢਾਬੇ ਤੋਂ ਗੱਲ ਕਰ ਰਹੇ ਹੋ ਜੀ ਮੈਂ ਕੰਵਲਜੀਤ ਬੋਲ ਰਹੀ ਹਾਂ ਰੈਲ ਮਾਜਰੇ ਤੋਂ ਤੁਹਾਡੇ ਨਾਲ ਮੇਰੀ ਪਹਿਲਾਂ ਦੋ ਘੰਟੇ ਗੱਲ ਹੋਈ ਸੀ ਜਿਸ ਵਿੱਚ ਮੈਂ ਆਪਣੇ ਭੋਜਨ ਦਾ ਔਡਰ ਕੀਤਾ ਸੀ ਜਿਹਦੇ ਵਿੱਚ ਦਾਲ ਮੱਖਣੀ ਸ਼ਾਹੀ ਪਨੀਰ ਕੜਾਹੀ ਪਨੀਰ ਮਿਕਸ ਵੈੱਜ ਰਾਇਤਾ ਚਾਵਲ ਤੰਦੂਰੀ ਰੋਟੀਆਂ ਮਿੱਸੀ ਰੋਟੀ ਲੱਛਾ ਪਰੌਂਠਾ ਅ ਲੱ ਲੱਸੀ ਕੋਕ ਵਗੈਰਾ ਜਿਹੜੇ ਸ਼ਾਮਿਲ ਨੇ ਮੈਂ ਇਹਦੇ ਵਿੱਚ ਕੁਛ ਮਠਿਆਈਆਂ ਐਡ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਗੁਲਾਬ ਜਾਮੁਨ ਆਈਸਕ੍ਰੀਮ ਮਿਲਕ ਕੇਕ ਅਤੇ ਇਹਨਾਂ ਨੂੰ ਐਡ ਕੀਤਾ ਜਾਵੇ ਇਹਨਾਂ ਦਾ ਭੁਗਤਾਨ ਮੈਂ ਔਨਲਾਈਨ ਜਾਂ ਔਫਲਾਈਨ ਦੋਨੋਂ ਤਰ੍ਹਾਂ ਨਾਲ ਕਰ ਦਵਾਂਗੀ ਇਹ ਆਡਰ ਮੈਨੂੰ ਸ਼ਾਮ ਪੰਜ ਵਜੇ ਤੱਕ ਚਾਹੀਦਾ ਹੈ ਕਿਉਂਕਿ ਮੇਰੀ ਜਨਮ ਦਿਨ ਪਾਰਟੀ ਹੈ ਜਿਸ ਕਰਕੇ ਮੇਰੇ ਸਾਰੇ ਰਿਸ਼ਤੇਦਾਰ ਮੇਰੇ ਘਰ ਆ ਰਹੇ ਨੇ ਅਤੇ ਇਹ ਖਾਣਾ ਮੈਨੂੰ ਸਮੇਂ ਸਿਰ ਚਾਹੀਦਾ ਹਰ ਵਾਰੀ ਖਾਣਾ ਮੈਂ ਤੁਹਾਡੇ ਰੈਸ ਰੈਸਟੋਰੈਂਟ ਤੋਂ ਹੀ ਮੰਗਾਉਨੀ ਹਾਂ ਕਿਉਂਕਿ ਤੁਹਾਡੇ ਰੈਸਟੋਰੈਂਟ ਦਾ ਖਾਣਾ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਇਸ ਲਈ ਪਲੀਜ਼ ਜਿੰਨਾ ਵੀ ਮੇਰਾ ਔਡਰ ਹੈ ਇਹ ਸਮੇਂ ਸਿਰ ਮੈਨੂੰ ਭੁਗਤਾਨ ਕੀਤਾ ਜਾਵੇ ਧੰਨਵਾਦ